ਹੈਲੋ ਬਸ ਅਮਨ ਠੀਕ ਆ ਵੀਰੇ ਤੂੰ ਸੁਣਾ ਬਸ ਕੁਛ ਨਹੀਂ ਘਰ ਸੀ ਹਾਂਜੀ ਹਾਂ ਵਧੀਆ ਵੀਰੇ ਤੂੰ ਦੱਸ

ਹਾਂ ਹਾਂ ਦੇਖ ਕਿਤੇ ਲੱਗ ਰਿਹਾ ਆਪਾਂ ਮੈਂ ਤਾਂ ਇਹ ਸੋਚ ਰਹੇ ਸੀਗਾ ਵੀ ਆਪਾਂ ਆਪਣੇ ਅਮਲੋਹ ਜਿਹੜੀ ਆਪਣੀ ਦੇਸ਼ ਭਗਤ ਯੂਨੀਵਰਸਿਟੀ ਹੈ ਉਹ 'ਚ ਟਰਾਈ ਕਰੀਏ ਅੱਛਾ ਹਾਂ ਹਾਂ ਇਹ ਤਾਂ ਹੈ ਫਿਰ ਹੋਰ ਤੂੰ ਦੱਸ ਤੂੰ ਤੂੰ ਸਲਾਹ ਦੇ ਫਿਰ ਕਿੱਥੇ ਲੱਗੀਏ ਆਪਾਂ ਫਤਿਹਗੜ੍ਹ ਸਾਹਿਬ ਹਾਂ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਅੱਛਾ ਚੱਲ ਉਹਦੇ ਵਿੱਚ ਟਰਾਈ ਕਰ ਲੈਂਦੇ ਆ ਫਿਰ ਹਾਂਜੀ ਹਾਂ ਠੀਕ ਆ ਠੀਕ ਆ ਫਿਰ ਅੱਗੇ ਕੋਰਸ ਕੁਰਸ ਕੀ ਕਰਨਾ ਉੱਥੇ ਹਾਂ ਬੀ ਏ ਠੀਕ ਆ ਕੋਈ ਗੱਲ ਨਹੀਂ ਆਪਾਂ ਦੋਵੇਂ ਲੱਗਦੇ ਆ ਦੋਵਾਂ ਨੇ ਇਕੱਠਿਆਂ ਨੇ ਹੀ ਕਰਨਾ ਇਕੱਠੇ ਈ ਲੱਗਾਂਗੇ ਬੀ ਏ ਦੇ ਵਿੱਚ ਲੱਗ ਜਾਂਦੇ ਆ ਨਾਲੇ ਸਾਥ ਬਣਿਆ ਰਹੇਗਾ ਆਪਣਾ ਦੋਹਾਂ ਦਾ ਅੱਛਾ ਚਲ ਫਿਰ ਇੱਦਾਂ ਕਰਦੇ ਆ ਆਪਾਂ ਗੇੜ੍ਹਾ ਮਾਰੇ ਆਉਂਦੇ ਆ ਕੱਲ ਨੂੰ ਚਲਦੇ ਹਾਂ ਉੱਥੇ ਨੂੰ ਹਾਂ ਅਤੇ ਆਪਣੇ ਕਿਸੇ ਉਹਨੂੰ ਪ੍ਰਿੰਸੀਪਲ ਨੂੰ ਮਿਲ ਆਉਂਦੇ ਜਾ ਕੇ ਸਾਰੀ ਗੱਲਬਾਤ ਕਰਕੇ ਜੋ ਵੀ ਹੋਇਆ ਫਿਰ ਆਪਾਂ ਹਾਂ ਫਿਰ ਐਡਮਿਸ਼ਨ ਕਰਾ ਕੇ ਆਪਾਂ ਰੈਗੂਲਰ ਹੋ ਜਾਂਗੇ ਯਾਰ ਹਾਂ ਹਾਂ ਬਸ ਠੀਕ ਆ ਵੀਰੇ ਕੱਲ੍ਹ ਨੂੰ ਫਿਰ ਤਿਆਰ ਰਹੋ ਆਪਣਾ ਰੱਖਿਓ ਓਕੇ ਓਕੇ